ਬੀ ਆਰ ਐਸ ਨਗਰ ਬੱਤੀ ਸੈਕਟਰ ਪ੍ਰਤਾਪ ਚੌਂਕ ਗਿਲ ਚੌਂਕ ਲੇਬਰ ਚੌਂਕ ਕੁਆਲਿਟੀ ਚੌਂਕ ਮੌਡਲ ਟਾਊਨ ਕਿਪਸ ਮਾਰਕੀਟ ਫਿਰੋਜ਼ ਗਾਂਧੀ ਮਾਰਕੀਟ ਏ ਸੀ ਮਾਰਕੀਟ ਗੁੜ ਮੰਡੀ ਕਰੀਮਪੁਰਾ ਬਾਜ਼ਾਰ ਚੌੜਾ ਬਾਜ਼ਾਰ